ਹਾਂਜੀ ਸਾਨੂੰ ਖੇਤੀਬਾੜੀ ਦੇ ਅਧਾਰ 'ਤੇ ਸਰਕਾਰ ਵੱਲੋਂ ਕਾਫੀ ਲਾਭ ਮਿਲਦਾ ਹੈ ਅਤੇ ਕਰਜ਼ ਵੀ ਮਿਲਦੇ ਹਨ ਅਤੇ ਕਾਫੀ ਬੈਨੀਫਿਟ ਕਾਫੀ ਬੈਨੀਫਿਟ ਮਿਲਦਾ ਹੈ ਸਾਨੂੰ ਸਰਕਾਰ ਵੱਲੋਂ ਅਤੇ ਜਿੱਦਾਂ ਕਿ ਅਸੀਂ ਕੋਈ ਵੀ ਸਬਜ਼ੀ ਜਾਂ ਕੁਛ ਵੀ ਬੀਜਣਾ ਹੋਵੇ ਅਸੀਂ ਸਰਕਾਰ ਸਾਨੂੰ ਲੋਨ ਦਿੰਦੀ ਹੈ ਅਤੇ ਲਿਮਟ ਬਣਾ ਕੇ ਦਿੰਦੀ ਆ ਖੇਤਾਂ 'ਤੇ ਅਤੇ ਸਰਕਾਰ ਵੱਲੋਂ ਸਾਨੂੰ ਕਾਫੀ ਬੈਨੀਫਿਟ ਮਿਲਦੇ ਹਨ ਸੀਜ਼ਨ ਦੇ ਹਿਸਾਬ 'ਚ ਅਤੇ ਕਈ ਸਰਕਾਰ ਵੱਲੋਂ ਫੈਸਿਲੀਟੀ ਮਿਲਦੀਆਂ ਹਨ ਜਿੱਦਾਂ ਕਿ ਯੂਰੀਆ ਹੋਰ ਕਾਫੀ ਜਾਣੀ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਮਿਲਦਾ ਹੈ